ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਦਾਸਪੁਰ ਤੋਂ ਰੇਖਾ ਬੋਲਦੀ ਪਈ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕਾਫੀ ਤਕਲੀਫ਼ ਆ ਮੈਂ ਕਾਫੀ ਹਫ਼ਤੇ ਮਹੀਨੇ 'ਚ ਦੋ ਵਾਰ ਹੋਸਪਿਟਲ ਜਾਣਾ ਹੀ ਪੈਂਦਾ ਹੈ ਕਿਉਂਕਿ ਮੈਨੂੰ ਕਾਫੀ ਪ੍ਰੋਬਲਮ ਆ ਮੈਂ ਚੈਕਅਪ ਕਰਵਾਉਣ ਲਈ ਜਾਂਦੀ ਹਾਂ ਸਮੱਸਿਆ ਮੈਨੂੰ ਸਰਵਾਈਕਲ ਦੀ ਆ ਮਾਈਗਰੇਨ ਦੀ ਇਹ ਵੀ ਹੈਗੀ ਆ ਬੈਕ ਪੇਨ ਵੀ ਹੈਗੀ ਆ ਕਿਉਂ ਕਈ ਤਰ੍ਹਾਂ ਦੇ ਨੁਕਸ ਆ ਮੈਨੂੰ ਥੋੜ੍ਹੀ ਲੱਤ 'ਚ ਵੀ ਪ੍ਰੋਬਲਮ ਆ ਇਸ ਕਰਕੇ ਮੈਨੂੰ ਰੁਟੀਨ ਚੈੱਕਅਪ ਲਈ ਜਾਣਾ ਪੈਂਦਾ ਜ਼ਰੂਰੀ ਹਾਂਜੀ ਹਰ ਮਹੀਨੇ 'ਚ ਦੋ ਵਾਰ ਤਾਂ ਹੋਸਪਿਟਲ ਜਾਣਾ ਹੀ ਪੈਂਦਾ ਹੈ ਹੋਸਪਿਟਲ ਜਾ ਕੇ ਮੈਂ ਰੂਟੀਨ ਚੈਕ ਅਪ ਕਰਵਾਉਂਦੀ ਹਾਂ ਹਾਂਜੀ